ਹੈਲੋ ਹਾਂਜੀ ਫਲਿੱਪਕਾਰਟ ਮੈਂ ਇੱਕ ਅਨਾਰਕਲੀ ਕੁੜਤੀ ਔਡਰ ਕੀਤੀ ਸੀ ਤੁਹਾਡੇ ਤੋਂ ਬਲੂ ਕਲਰ 'ਚ ਤੁਸੀਂ ਮੇਰੇ ਰੀਸੈਂਟ ਔਡਰ 'ਚ ਦੇਖ ਸਕਦੇ ਹੋ ਮੈਂ ਉਹਦੇ ਬਾਰੇ ਕੁਝ ਪੋਜੀਟਿਵ ਫੀਡਬੈਕ ਦੇਣਾ ਸੀ ਹਾਂਜੀ ਮੈਂ ਜਦੋਂ ਔਡਰ ਕੀਤਾ ਸੀ ਤਾਂ ਥੋੜ੍ਹੇ ਉਹਦੇ ਰਿਵਿਊਜ਼ ਥਰੀ ਪੁਆਇੰਟ ਨਾਇਨ ਥਰੀ ਪੁਆਇੰਟ ਏਟ ਹੀ ਸੀ ਤਾਂ ਮੈਨੂੰ ਸ਼ਾਇਦ ਲੱਗਿਆ ਸੀ ਕਿ ਇੰਨਾ ਵਧੀਆ ਨਹੀਂ ਹੋਏਗਾ ਜਦ ਮੈਂ ਉਹਨੂੰ ਵੋਸ਼ ਕੀਤਾ ਤਾਂ ਉਹਦਾ ਇੱਕ ਪਰਸੈਂਟ ਵੀ ਕਲਰ ਨਹੀਂ ਨਿਕਲਿਆ ਪਲਸ ਮੈਂ ਜਦੋਂ ਪਾਇਆ ਤਾਂ ਉਹ ਸਭ ਨੇ ਐਨੀ ਜ਼ਿਆਦਾ ਤਾਰੀਫ ਕੀਤੀ ਬਹੁਤ ਹੀ ਮਲਮਲ ਦਾ ਕੱਪੜਾ ਬੜਾ ਹੀ ਅੱਛਾ ਸੀ ਔਰ ਅਨਾਰਕਲੀ ਲੁੱਕ ਵੈਸੇ ਹੀ ਮੈਨੂੰ ਬੜੀ ਹੀ ਵਧੀਆ ਲੱਗਦੀ ਹੈ ਫ੍ਰੋਕ ਸਟਾਈਲ ਦਾ ਕੱਪੜਾ ਸੀ ਹਾਂਜੀ ਅਤੇ ਉਹਦੇ ਚਾਰਜਿਸ ਵੀ ਮੈਨੂੰ ਠੀਕ ਲੱਗੇ ਤਾਂ ਕਰਕੇ ਮੈਂ ਔਡਰ ਕੀਤਾ ਸੀ ਮੈਂ ਚਾਹੁੰਦੀ ਹਾਂ ਕੰਪਨੀ ਐਦਾਂ ਦੇ ਹੋਰ ਪ੍ਰੋਡਕਟਸ ਲੋਂਚ ਕਰੇ ਤਾਂ ਕਿ ਮੈਂ ਹੋਰ ਬਾਏ ਕਰ ਸਕਾਂ ਅਤੇ ਮੈਂ ਦੂਸਰਿਆਂ ਨੂੰ ਵੀ ਰੀਕਮੈਂਡ ਕੀਤਾ ਹੈ ਕਿ ਉਹ ਸਾਰੇ ਇਹ ਪ੍ਰੋਡਕਟਸ ਬਾਏ ਕਰਨ ਕਿਉਂਕਿ ਉਹਨਾਂ ਦੇ 'ਚ ਹੋਰ ਵੀ ਕਲਰਸ ਸੀ ਰੈੱਡ ਸੀ ਬਲੂ ਸੀ ਮਹਿਰੂਨ ਸੀ ਮੈਂ ਰੈੱਡ ਮੈਂ ਬਲੂ ਔਡਰ ਕੀਤਾ ਸੀ ਅਤੇ ਮੇਰਾ ਬਹੁਤ ਅੱਛਾ ਲੱਗ ਰਿਹਾ ਸੀ ਤਾਂ ਸਭ ਨੇ ਬਹੁਤ ਤਾਰੀਫ ਕੀਤੀ ਥੈਂ